ਜੇਕਰ ਮੈਂ ਟਰੋਫੀਆਂ ਦੀ ਗੱਲ ਕਰਾਂ ਤਾਂ ਰਾਜ ਪੱਧਰੀ ਕਬੱਡੀ ਟੂਰਨਾਮੈਂਟ ਟਰੋਫੀ ਇੱਕ ਬਹੁਤ ਹੀ ਵੱਡੀ ਟਰੋਫੀ ਹੈ ਜਿਹੜੀ ਕਿ ਰਾਜ ਲੈਵਲ 'ਤੇ ਕਬੱਡੀ ਦੀ ਗੇਮ ਨੂੰ ਖੇਡਣ ਤੋਂ ਬਾਅਦ ਮਿਲਦੀ ਹੈ ਇਸ ਟਰੋਫੀ ਨੂੰ ਲੈਣ ਲਈ ਪਹਿਲਾਂ ਤਾਂ ਖਿਡਾਰੀ ਨੂੰ ਰਾਜ ਲੈਵਲ 'ਤੇ ਕਬੱਡੀ ਦੀ ਖੇਡ ਨੂੰ ਖੇਡਣਾ ਪਵੇਗਾ ਅਤੇ ਉਸਨੂੰ ਜਿੱਤਣਾ ਪਵੇਗਾ ਇਸ ਖੇਡ ਤੱਕ ਪਹੁੰਚਣ ਲਈ ਉਸਨੂੰ ਪਹਿਲਾਂ ਤਾਂ ਲੋਕਲ ਲੈਵਲ ਜਿੱਦਾਂ ਕਿ ਪਿੰਡਾਂ ਦੇ ਵਿੱਚ ਗੇਮਾਂ ਨੂੰ ਖੇਡਣਾ ਪਏਗਾ ਅਤੇ ਉਸ ਤੋਂ ਬਾਅਦ ਆਪਣੇ ਡਿਸਟਰਿਕਟ ਲੈਵਲ 'ਤੇ ਗੇਮਾਂ ਨੂੰ ਖੇਡਣਾ ਪਵੇਗਾ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਅੱਗੇ ਅੱਗੇ ਤਰੱਕੀ ਕਰਦੇ ਕਰਦਿਆਂ ਉਹ ਸਟੇਟ ਲੈਵਲ ਦੀਆਂ ਗੇਮਾਂ ਤੱਕ ਪਹੁੰਚਦਾ ਹੈ ਜਦੋਂ ਉਹ ਸਟੇਟ ਲੈਵਲ ਦੀਆਂ ਗੇਮਾਂ ਤੱਕ ਪਹੁੰਚਦਾ ਹੈ ਤਾਂ ਉਸ ਨੂੰ ਇਹ ਟਰੋਫੀ ਮਿਲਦੀ ਹੈ ਉਸਨੂੰ ਟਰੋਫੀ ਮਿਲਣ ਤੋਂ ਬਾਅਦ ਫਿਰ ਇਹਨਾਂ ਦੀ ਕਈ ਵਾਰ ਸਲੈਕਸ਼ਨ ਸਰਕਾਰੀ ਨੌਕਰੀਆਂ ਵਿੱਚ ਵੀ ਹੋ ਜਾਂਦੀ ਹੈ ਜਿਵੇਂ ਕਿ ਕੁਝ ਫੇ ਮਸ਼ਹੂਰ ਖਿਲਾੜੀ ਹੈ ਸੰਦੀਪ ਨੰਗਲੀ ਹੈ ਮਨਿੰਦਰ ਸਿੰਘ ਹੈ ਰਾਹੁਲ ਚੌਧਰੀ ਹੈ ਇਹ ਸਾਰੇ ਰਾਜ ਲੈਵਲ ਦੇ ਕਬੱਡੀ ਖਿਡਾਰੀ ਰਹਿ ਚੁੱਕੇ ਹਨ